ਹਾਂਜੀ ਅਸੀਂ ਜ਼ਰੂਰ ਸੋਚਦੇ ਹਾਂ ਕਿ ਟੈਕਨੋਲੋਜੀ ਸਾਡੇ ਮਨੋਰੰਜਨ ਦੇ ਤਰੀਕੇ ਨੂੰ ਬਦਲ ਰਹੀ ਹੈ ਕਿਉਂਕਿ ਇੱਕ ਅੱਜ ਦੇ ਸਮੇਂ ਵਿੱਚ ਸਾਰੇ ਬੱਚੇ ਬਾ ਬਾਹਰਲੀਆਂ ਗੇਮਾਂ ਨੂੰ ਛੱਡ ਕੇ ਫੋਨਾਂ ਉੱਤੇ ਲੱਗੇ ਰਹਿੰਦੇ ਹਨ ਜੋ ਕਿ ਉਹਨਾਂ ਦੀ ਸਿਹਤ ਲਈ ਬਹੁਤ ਖਰਾਬ ਹੈ ਇਸ ਨਾਲ ਇਸ ਯੁਗ ਵਿੱਚ ਕਈ ਸਾਰੀਆਂ ਬਿਮਾਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਜ਼ਿਆਦਾਤਰ ਬੱਚਿਆਂ ਦੀਆਂ ਅੱਖਾਂ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਹਨ ਜਿਸ ਨਾਲ ਉਹਨਾਂ ਨੂੰ ਚਸ਼ਮੇ ਵਗੈਰਾ ਲੱਗ ਜਾਂਦੇ ਹਨ ਕਈ ਤਾਂ ਇਸ ਟੈਕਨੋਲੋਜੀ ਦੇ ਇੰਨੇ ਜ਼ਿਆਦਾ ਅਧੀਨ ਹੋ ਚੁੱਕੇ ਹੁੰਦੇ ਹਨ ਕਿ ਉਹਨਾਂ ਨੂੰ ਆਲੇ ਦੁਆਲੇ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਅੱਜ ਦੇ ਯੁੱਗ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਟੈਕਨੋਲੋਜੀ ਦੇ ਅਧੀਨ ਹੋ ਚੁੱਕੇ ਹਨ ਟੈਕਨੋਲੋਜੀ ਇੱਕ ਅਜਿਹੀ ਚੀਜ਼ ਹੈ ਜੋ ਕਿ ਸਭ ਨੂੰ ਆਪਣੇ ਆਪਣੇ ਕੋਲ ਆਉਣ ਵਾਸਤੇ ਮਜਬੂਰ ਕਰਦੀ ਹੈ ਬੱਚੇ ਅੱਜ ਕੱਲ੍ਹ ਬਾਹਰਲੀਆਂ ਗੇਮਾਂ ਨੂੰ ਛੱਡ ਕੇ ਘਰੇ ਹੀ ਮੋਬਾਈਲ ਵਿੱਚ ਯੂਟਿਊਬ ਵਟਸਐਪ ਅਤੇ ਹੋਰ ਐਪਲੀਕੇਸ਼ਨਾਂ ਚਲਾਉਣਾ ਜ਼ਰੂਰੀ ਸਮਝਦੇ ਹਨ ਨਾ ਕਿ ਬਾਹਰਲੀਆਂ ਗੇਮਾਂ ਖੇਡਣੀਆਂ ਜਿਵੇਂ ਕਿ ਜਿਵੇਂ ਕਿ ਰੱਸਾ ਟੱਪਣਾ ਅਤੇ ਹੋਰ

ਐਕਸਰਸਾਈਜ਼ਾ ਕਰਨੀਆਂ ਅਤੇ ਅੱਜ ਦੇ ਯੁੱਗ ਵਿੱਚ ਹਰ ਇਨਸਾਨ ਟੈਕਨੋਲੋਜੀ ਦਾ ਦੀਵਾਨਾ ਹੋ ਚੁੱਕਿਆ ਹੈ